ਸਤਿ ਸ਼੍ਰੀ ਅਕਾਲ ਸਰ ਮੈਂ ਕੱਲ੍ਹ ਤੁਹਾਡੇ ਰੈਸਟੋਰੈਂਟ ਤੋਂ ਖਾਣਾ ਔਡਰ ਕੀਤਾ ਸੀ ਮੇਰੇ ਕੁਝ ਦੋਸਤ ਆਏ ਸੀ ਬਾਹਰੋਂ ਜੋ ਮੈਨੂੰ ਕਹਿ ਰਹੇ ਸੀ ਕਿ ਤੁਹਾਡੇ ਸ਼ਹਿਰ ਦੇ ਸਭ ਤੋਂ ਵਧੀਆ ਰੈਸਟੋਰੈਂਟ ਦਾ ਖਾਣਾ ਖਾਣਾ ਹੈ ਅਤੇ ਮੈਂ ਹਮੇਸ਼ਾ ਖਾਣਾ ਤੁਹਾਡੇ ਹੀ ਰੈਸਟੋਰੈਂਟ ਤੋਂ ਮੰਗਵਾਉਂਦੀ ਹਾਂ ਅਤੇ ਮੈਂ ਕੱਲ੍ਹ ਤੁਹਾਡੇ ਰੈਸਟੋਰੈਂਟ ਤੋਂ ਕੁਝ ਖਾਣਾ ਔਡਰ ਕੀਤਾ ਸੀ ਜਿਹਦੇ ਵਿੱਚ ਕੁਝ ਚਾਵਲ ਮਨਚੂਰੀਅਨ ਅਤੇ ਸ਼ਾਹੀ ਪਨੀਰ ਔਡਰ ਕੀਤਾ ਸੀ ਜਦੋਂ ਖਾਣਾ ਆਇਆ ਤਾਂ ਮੈਂ ਉਹਨੂੰ ਆਪਣੇ ਦੋਸਤਾਂ ਦੇ ਅੱਗੇ ਪਰੋਸਿਆ ਅਤੇ ਜਦੋਂ ਉਹ ਖਾਣਾ ਖਾਣ ਲੱਗੇ ਤਾਂ ਉਹਨਾਂ ਨੇ ਖਾਣਾ ਦੀ ਪਹਿਲੀ ਹੀ ਬਾਈਟ ਲਈ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਖਾਣਾ ਖਾਦਾ ਨਹੀਂ ਜਾਵੇਗਾ ਕਿਉਂਕਿ ਇਹ ਖਾਣਾ ਫਰੈਸ਼ ਨਹੀਂ ਹੈ ਤਾਜ਼ਾ ਨਹੀ ਹੈ ਇਹ ਖਾਣਾ ਬਿਹਾ ਹੈ ਇਹਦੇ ਵਿੱਚੋਂ ਖੱਟੀ ਸਮੈੱਲ ਆ ਰਹੀ ਹੈ ਅਤੇ ਜਦੋਂ ਮੈਂ ਪਨੀਰ ਦੀ ਬਾਈਟ ਮੈਂ ਖਾਦੀ ਤਾਂ ਪਨੀਰ ਤਾਂ ਬਿਹਾ ਲੱਗ ਰਿਹਾ ਸੀ ਬਿਲਕੁਲ ਹੀ ਤਾਜ਼ਾ ਨਹੀਂ ਸੀ ਅਤੇ ਚਾਵਲ ਇਸ ਤਰ੍ਹਾਂ ਲੱਗ ਰਹੇ ਸੀ ਕਿ ਜਿਹਦੇ ਵਿੱਚ ਤੁਸੀਂ ਕੱਲ੍ਹ ਦੇ ਹੀ ਗਰਮ ਕਰਕੇ ਭੇਜ ਦਿੱਤੇ ਹੋਣ ਮੈਨੂੰ ਬੜੀ ਹੀ ਨਮੋਸ਼ੀ ਹੋਈ ਮੈਨੂੰ ਬੜਾ ਹੀ ਬੁਰਾ ਲੱਗਾ ਕਿ ਮੈਂ ਤਾਂ ਹਮੇਸ਼ਾ ਹੀ ਤੁਹਾਡੇ ਰੈਸਟੋਰੈਂਟ ਤੋਂ ਖਾਣਾ ਮੰਗਵਾਉਂਦੀ ਹਾਂ ਔਰ ਤੁਸੀਂ ਇੰਨਾ ਖਰਾਬ ਖਾਣਾ ਅੱਜ ਮੈਨੂੰ ਭੇਜਿਆ ਹੈ ਬਿਲਕੁਲ ਹੀ ਉਹਦੇ ਵਿੱਚ ਕੋਈ ਵੀ ਤਾਜ਼ੀ ਨਹੀਂ ਸੀ ਮੇਰੇ ਪੈਸੇ ਵੀ ਖਰਾਬ ਗਏ ਅਤੇ ਮੇਰੇ ਘਰ ਜੋ ਮੇਰੇ ਦੋਸਤ ਆਏ ਸੀ ਉਹ ਵੀ ਭੁੱਖੇ ਗਏ ਅਤੇ ਮੇਰਾ ਤਾਂ ਮੇਰੇ ਪੈਸਿਆਂ ਦਾ ਵੀ ਨੁਕਸਾਨ ਹੋਇਆ ਅਤੇ ਮੇਰੀ ਜੋ ਬੇਇੱਜ਼ਤੀ ਹੋਈ ਉਹ ਵੱਖਰੀ ਮੇਰੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਮੈਨੂੰ ਮੇਰੇ ਪੈਸੇ ਵਾਪਿਸ ਦੇ ਦਿੱਤੇ ਜਾਣ ਅਤੇ ਅੱਗੇ ਤੋਂ ਕਦੇ ਵੀ ਇਹੋ ਜਿਹਾ ਬਿਹਾ ਭੋਜਨ ਨਾ ਭੇਜਿਆ ਜਾਵੇ ਹਮੇਸ਼ਾ ਤਾਜ਼ਾ ਅਤੇ ਸਾਫ਼ ਹੀ ਭੋਜਨ ਭੇਜਿਆ ਜਾਵੇ ਧੰਨਵਾਦ